ਹੈਲੋ ਸਤਿ ਸ਼੍ਰੀ ਅਕਾਲ ਮੈਮ ਦੱਸੋ ਕਿਵੇਂ ਆਉਣਾ ਹੋਇਆ ਹਾਂਜੀ ਮੈਮ ਕੱਪੜਾ ਕਿਸ ਤਰ੍ਹਾਂ ਦਾ ਤੁਹਾਡਾ ਹੈਵੀ ਹੈ ਮੈਮ ਫਿਰ ਤਾਂ ਲੱਗਣੀ ਆ ਮੈਮ ਚਾਰਜਿਸ ਕੁ ਕੁਝ ਵੀ ਜੋ ਵੀ ਤੁਹਾਡੀ ਮਰਜ਼ੀ ਹੋਈ ਹਾਂਜੀ ਮੈਂ ਪੰਜ ਸੌ ਹਾਂਜੀ ਹਾਂਜੀ ਮੈਮ ਮੈਂ ਪੰਜ ਸੌ ਲੈਂਦੀ ਹਾਂ ਹਾਂਜੀ